ਮੈਨੂੰ ਆਪਣੇ ਘਰ ਦੀ ਸਫਾਈ ਕਰਨਾ ਬਹੁਤ ਪਸੰਦ ਹੈ ਮੈਂ ਆਪਣੇ ਘਰ ਦੀ ਸਫਾਈ ਦੋ ਟਾਈਮ ਕਰਦੀ ਹਾਂ ਮੈਂ ਆਪਣੇ ਘਰ ਦੀ ਸਫਾਈ ਕਰਨ ਦੇ ਨਾਲ ਨਾਲ ਆਪਣੇ ਘਰ ਦਾ ਆਲਾ ਦੁਆਲਾ ਵੀ ਸਾਫ਼ ਰੱਖਦੀ ਹਾਂ ਹਾਲਾਂਕਿ ਘਰ ਦੇ ਬਾਹਰ ਸਾਡੇ ਸਫਾਈ ਕਰਨ ਵਾਸਤੇ ਸਫਾਈ ਕਰਮਚਾਰੀ ਆਉਂਦੇ ਨੇ ਪਰ ਫਿਰ ਵੀ ਮੈਂ ਆਪਣੇ ਘਰ ਦੇ ਬਾਹਰ ਝਾੜੂ ਲਗਾਉਂਦੀ ਹਾਂ ਜਦੋਂ ਮੈਨੂੰ ਦਿਖਦਾ ਹੈ ਕਿ ਮੇਰੇ ਘਰ ਦੇ ਆਲੇ ਦੁਆਲੇ ਕੂੜਾ ਕਰਕਟ ਇਕੱਠਾ ਹੈ ਤਾਂ ਮੈਂ ਉਹਨੂੰ ਸਾਫ਼ ਕਰਕੇ ਕੂੜਾਦਾਨ ਵਿੱਚ ਪਾ ਦਿੰਦੀ ਹਾਂ ਮੈਂ ਆਪਣੇ ਘਰ ਦਾ ਕੂੜਾ ਦੋ ਹਿੱਸਿਆਂ ਵਿੱਚ ਰੱਖਦੀ ਹਾਂ ਘਰ ਦਾ ਗਿੱਲਾ ਕੂੜਾ ਜਿਵੇਂ ਕਿ ਸਬਜ਼ੀਆਂ ਭੋਜਨ ਬਚੇ ਹੋਏ ਹਿੱਸੇ ਫਲ ਆਦਿ ਨੂੰ ਅਲੱਗ ਅਤੇ ਸੁੱਕੇ ਲਾਈ ਲ ਹਿੱਸੇ ਨੂੰ ਪਲਾਸਟਿਕ ਕਾਗਜ਼ ਧਾਤੂਆਂ ਨੂੰ ਅਲੱਗ ਰੱਖਦੀ ਹਾਂ ਪਲਾਸਟਿਕ ਦੀ ਵਰਤੋਂ ਮੈਂ ਘੱਟ ਕਰਦੀ ਹਾਂ ਇੱਕੋ ਵਾਰ ਵਰਤੇ ਜਾਣ ਵਾਲੇ ਪਲਾਸਟਿਕ ਦੀ ਥਾਂ ਕੱਪੜੇ ਦੀ ਥੈਲੀ ਸਟੀਲ ਜਾਂ ਮਿੱਟੀ ਦੇ ਬਰਤਨ ਵਰਤਦੀ ਹਾਂ ਹਫ਼ਤੇ ਵਿੱਚ ਇੱਕ ਵਾਰ ਮੁਹੱਲੇ ਦੀ ਸਫਾਈ ਅਸੀਂ ਰਲ ਮਿਲ ਕੇ ਕਰਦੇ ਹਾਂ ਅਤੇ ਮੈਂ ਆਪਣੇ ਨਾਲ ਦੇ ਸ ਕਰਮਚਾਰੀਆਂ ਨੂੰ ਆਪਣੇ ਦੋਸਤਾਂ ਨੂੰ ਵੀ ਨਾਲ ਲੈ ਕੇ ਮੁਹੱਲੇ ਦੀ ਸਫਾਈ ਕਰਦੇ ਹਾਂ ਮੈਨੂੰ ਪੇੜ ਪੌਦੇ ਬਹੁਤ ਪਸੰਦ ਹਨ ਮੈਂ ਆਪਣੇ ਘਰ ਦੇ ਬਾਹਰ ਬਹੁਤ ਸਾਰੇ ਫਲ ਬੂਟੇ ਲਗਾਏ ਹੋਏ ਹਨ ਲੋਕਾਂ ਨੂੰ ਮੈਂ ਜਾਗਰੂਕ ਕਰਦੀ ਹਾਂ ਕਿ ਆਪਣੇ ਆਪਣੇ ਆਲੇ ਦੁਆਲੇ ਦੀ ਸਫਾਈ ਰੱਖਣਾ ਬਹੁਤ ਜ਼ਰੂਰੀ ਹੈ ਅਤੇ ਕੂੜਾ ਸੁੱਟਦੇ ਸਮੇਂ ਧਿਆਨ ਰੱਖੋ ਕਿ ਅਸੀਂ ਕੂੜਾ ਹਮੇਸ਼ਾ ਕੂੜਾਦਾਨ ਵਿੱਚ ਹੀ ਸੁੱਟੀਏ ਧੰਨਵਾਦ